ਮੈਂ ਗੁਰਦੀਪ ਕੌਰ ਬੋਲ ਰਹੀ ਹਾਂ ਮੈਂ ਗਿਰਧਾਰੀ ਢਾਬੇ ਤੋਂ ਕਿੰਨੀ ਵਾਰ ਖਾਣਾ ਖਾਧਾ ਹੈ ਜੋ ਕਿ ਬਹੁਤ ਹੀ ਵਧੀਆ ਹੁੰਦਾ ਹੈ ਵੈਸੇ ਤਾਂ ਮੈਂ ਇਹ ਹਿਦਾਇਤ ਦੇਣਾ ਚਾਹੁੰਦੀ ਹਾਂ ਕਿ ਉੱਥੇ ਦੇ ਜਿਹੜਾ ਓਇਲੀ ਖਾਣਾ ਹੁੰਦਾ ਹੈ ਜੋ ਕਿ ਸਾਡੀ ਸਿਹਤ ਲਈ ਐਨਾ ਅੱਛਾ ਨਹੀਂ ਹੁੰਦਾ ਤੁਸੀਂ ਉਹਨਾਂ ਨੂੰ ਆਪਣੇ ਜੋ ਵੇਟਰ ਹੁੰਦੇ ਆ ਉਹਨਾਂ ਨੂੰ ਇਹ ਹਿਦਾਇਤ ਕਰੋ ਕਿ ਜਿਹੜਾ ਖਾਣਾ ਸਾਰੇ ਜਣੇ ਖਾਂਦੇ ਹਨ ਖਾਂਦੇ ਆ ਆ ਕੇ ਉੱਥੇ ਉਹਨਾਂ ਵਿੱਚ ਓਇਲ ਘੱਟ ਹੋਵੇ ਅਤੇ ਜਿਹੜੇ ਕਿ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਕਸਟਮਰ ਉੱਥੇ ਆਉਣ ਤਾਂ ਕਰਕੇ ਮੈਂ ਇਹ ਇੱਕ ਹੋਰ ਹਿਦਾਇਤ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਉੱਥੇ ਲੋਕ ਆਉਂਦੇ ਹਨ ਉਹਨਾਂ ਨੂੰ ਸਪੇਸ ਘੱਟ ਮਿਲਦੀ ਆ ਉੱਥੇ ਜੋ ਬੈਠਣ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਤਾਂ ਕਿ ਆਪਣੇ ਤੁਸੀਂ ਇਸ ਤਰ੍ਹਾਂ ਦਾ ਇੰਤਜ਼ਾਮ ਕਰੋ ਕਿ ਉੱਥੇ ਸਾਰੇ ਜਣੇ ਬੈਠ ਸਕਣ ਆ ਕੇ ਖਾਣਾ ਖਾ ਸਕਣ ਅਤੇ ਤਾਜ਼ਾ ਖਾਣਾ ਖਾ ਸਕਣ ਜਿਸ ਨਾਲ ਸਾਰਾ ਕੁਛ ਵਧੀਆ ਹੋ ਸਕੇ ਸਾਡੀ ਸਿਹਤ ਵਧੀਆ ਹੋ ਸਕੇ ਅਤੇ ਸਾਨੂੰ ਉੱਥੇ ਵਧੀਆ ਖਾਣਾ ਮਿਲ ਸਕੇ ਤਾਂ ਕਿ ਸਾਡੀ ਸਿਹਤ ਨੂੰ ਕੋਈ ਪ੍ਰੋਬਲਮ ਨਾ ਆਵੇ ਔਰ ਵਧੀਆ ਖਾਣਾ ਖਾਣ ਨਾਲ ਸਾਰੇ ਵਧੀਆ ਰਹਿੰਦੇ ਹਨ ਇਸ ਲਗ ਗਿਰਧਾਰੀ ਢਾਬੇ ਦਾ ਖਾਣਾ ਵੈਸੇ ਤਾਂ ਵਧੀਆ ਹੁੰਦਾ ਹੈ ਫਿਰ ਵੀ ਜੇਕਰ ਅਸੀਂ ਤੁਹਾਨੂੰ ਇਹ ਹਿਦਾਇਤ ਦੇ ਰਹੇ ਹਾਂ ਤਾਂ ਤੁਹਾਨੂੰ ਇਹਨਾਂ ਹਿਦਾਇਤਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਆ ਅਸੀਂ ਆਪਣਾ ਇੱਕ ਤਰ੍ਹਾਂ ਦਾ ਵਿਸ਼ਵਾਸ ਸਮਝਦੇ ਹਾਂ ਕਿ ਤੁਸੀਂ ਇਸ ਚੀਜ਼ ਨੂੰ ਕਰ ਸਕੋ